ਪੰਜ ਸਤੰਬਰ ਇਕ ਨੌਂ ਅੱਠ ਸੱਤ ਚਾਰ ਦਸੰਬਰ ਦੋ ਜੀਰੋ ਦੋੋ ਚਾਰ ਛੇ ਜਨਵਰੀ ਇੱਕ ਨੌਂ ਪੰਜ ਪੰਜ ਅੱਠ ਫਰਵਰੀ ਇੱਕ ਨੌਂ ਚਾਰ ਸੱਤ ਨੌਂ ਅਕਤੂਬਰ ਦੋ ਜੀਰੋ ਜੀਰੋ ਦੋ